ਜੇ ਅਸੀਂ ਤਰਨ ਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਜ਼ਿਆਦਾ ਮਸ਼ਹੂਰ ਜੇ ਇੱਕ ਚੀਜ਼ ਹੈ ਤਾਂ ਉਹ ਹੈਗੀ ਹੈ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਜਿਹੜਾ ਸਰਦੀਆਂ 'ਚ ਹਰ ਘਰ ਵਿੱਚ ਬਣਾਇਆ ਜਾਂਦਾ ਹੈ ਅਤੇ ਈਵਨ ਜੇ ਕੋਈ ਪਰਾਹੁਣਾ ਆਵੇ ਤਾਂ ਉਹਨੂੰ ਵੀ ਉਹੀ ਚੀਜ਼ ਜਿਹੜੀ ਆ ਉਹ ਸਰਵ ਕੀਤੀ ਜਾਂਦੀ ਹੈ ਕਿਉਂਕਿ ਵਿਲੇਜ ਏਰੀਆ ਹੋਣ ਕਰਕੇ ਸਰਸੋਂ ਦਾ ਸਾਗ ਜਿਹੜਾ ਉਹ ਤਾਂ ਘਰ ਮਿਲ ਜਾਂਦਾ ਹੈ ਅਤੇ ਉਹ ਉੱਥੋਂ ਘਰੋਂ ਹੀ ਤੋੜ ਕੇ ਅਤੇ ਉਹ ਬਣਾ ਦਿੰਦੇ ਨੇ ਉਹਦੇ 'ਚ ਕਿਤੇ ਉਹਨਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਅਤੇ ਜੇ ਆਪਾਂ ਇਹਨੂੰ ਬਣਾਉਣ ਦੀ ਤਕਨੀਕ ਦਾ ਵਰਤੋਂ ਅਗਰ ਦੇਖੀਏ ਕਿ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਕੁਛ ਲੋਕ ਇਹਨੂੰ ਗੈਸ 'ਤੇ ਵੀ ਬਣਾਉਂਦੇ ਨੇ ਲੇਕਿਨ ਇਹਦਾ ਜਿਹੜਾ ਸੱਭਿਆਚਾਰਕ ਤਰੀਕਾ ਉਹਨੂੰ ਚੁੱਲ੍ਹੇ 'ਤੇ ਬਣਾਉਣਾ ਹੈ ਅਤੇ ਚੁੱਲ੍ਹੇ 'ਤੇ ਬਣਿਆ ਹੋਇਆ ਸਾਗ ਦਾ ਤਾਂ ਸਵਾਦ ਹੀ ਵੱਖਰਾ ਹੁੰਦਾ ਵੈ ਇਹਨੂੰ ਬਣਾਉਣ ਵਾਸਤੇ ਤੁਹਾਨੂੰ ਸਾਗ ਚਾਹੀਦਾ ਹੁੰਦਾ ਵੈ ਬਾਥੂ ਚਾਹੀਦਾ ਹੁੰਦਾ ਅਤੇ ਪਾਲਕ ਚਾਹੀਦੀ ਹੁੰਦੀ ਹੈ ਇਹਨਾਂ ਤਿੰਨਾਂ ਨੂੰ ਕੱਟ ਕੇ ਅਤੇ ਕੂਕਰ 'ਚ ਪਾ ਕੇ ਅਤੇ ਰਿੰਨ੍ਹਣਾ ਰੱਖ ਦੇਈਦਾ ਵੈ ਅਤੇ ਫਿਰ ਹਰ ਬੰਦਾ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਇਹਦਾ ਤੜਕਾ ਬਣਾ ਲੈਂਦਾ ਇਹਦੇ ਜਿਹੜੇ ਦੋ ਮੁੱਖ ਹੋਰ ਤਰੀਕੇ ਨੇ ਉਹਦੇ ਵਿੱਚ ਲਸਣ ਅਤੇ ਪਿਆਜ਼ ਮੰਨੇ ਜਾਂਦੇ ਨੇ ਕਿ ਲਸਣ ਅਤੇ ਪਿਆਜ਼ ਦਾ ਜਿਹੜਾ ਉਹ ਤੜਕਾ ਤੁਸੀਂ ਲਗਾਉਂਦੇ ਹੋ ਅਤੇ ਉਹਨਾਂ ਦੋਨਾਂ ਚੀਜ਼ਾਂ ਦੇ ਨਾਲ ਹੀ ਜਿਹੜਾ ਉਹ ਸਾਗ ਜਿਹੜਾ ਉਹ ਬਣਾਇਆ ਜਾਂਦਾ ਵੈ ਅਤੇ ਉਸ ਤੋਂ ਬਾਅਦ ਜੇ ਆਪਾਂ ਵੇਖੀਏ ਕਿ ਇਤਿਹਾਸ ਨੂੰ ਅਤੇ ਕਹਿੰਦੇ ਕਿ ਆਹ ਜਿਹੜੀ ਪੰਜਾਬ ਦੀ ਹੈ ਇਹਨੂੰ ਆਪਾਂ ਜੇ ਆਪਾਂ ਪੰਜਾਬ ਦੇ ਸੱਭਿਆਚਾਰ ਨੂੰ ਕਹੀਏ ਤਾਂ ਉਹ ਇੱਥੋਂ ਹੀ ਦਰਸਾਇਆ ਜਾਂਦਾ ਕਿ ਸਾਗ ਅਤੇ ਮੱਕੀ ਦੀ ਰੋਟੀ ਨੂੰ ਹੀ ਜਿਹੜਾ ਉਹ ਸਭ ਤੋਂ ਖਾਸ ਮੰਨਿਆ ਜਾਂਦਾ ਵੈ ਅਤੇ ਇੱਥੇ ਦੇ ਲੋਕ ਜਿਹੜੇ ਨੇ ਇਹ ਇੱਥੇ ਦੇ ਪਕਵਾਨ ਜਿਹੜੇ ਨੇ ਇਹ ਇਹ ਮਤਲਬ ਇੱਥੇ ਦੇ ਪਕਵਾਨਾਂ ਦੇ ਵਿੱਚ ਜਿਹੜਾ ਨੰਬਰ ਵਨ ਪਕਵਾਨ ਜਿਹੜਾ ਉਹ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਹੀ ਮੰਨਿਆ ਜਾਂਦਾ ਵੈ ਅਤੇ ਇੱਥੇ ਬਾਕੀ ਜੇ ਤੁਸੀਂ ਖਾਣ ਦੀ ਗੱਲ ਕਰੋ ਕਿ ਕਿਹੜੀ ਐਸੀ ਜਗ੍ਹਾ ਜਿੱਥੇ ਤੁਸੀਂ ਜਾ ਕੇ ਖਾ ਸਕਦੇ ਹੋ ਅਤੇ ਇੱਥੇ ਇੱਕ ਗਿਆਨ ਦਾ ਢਾਬਾ ਹੈਗਾ ਹੈ ਜਿਹੜਾ ਮੇਨ ਬੋੜੀ ਚੌਂਕ ਦੇ ਲਾਗੇ ਪੈ ਜਾਂਦਾ ਵੈ ਤੁਸੀਂ ਉੱਥੇ ਜਾਉ ਤੁਹਾਨੂੰ ਉੱਥੇ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਜਿੱਥੇ ਪਿਓਰ ਵੈਜੀਟੇਰੀਅਨ ਹੈਗਾ ਵੈ ਅਤੇ ਇੱਕ ਪ੍ਰਤਾਪ ਸਵੀਟਸ ਵੀ ਇੱਥੇ ਖੁੱਲ੍ਹਿਆ ਵਾ ਨਵਾਂ ਹੀ ਸਾਡੇ ਅਤੇ ਜਿਹੜੇ ਰੇਲਵੇ ਸਟੇਸ਼ਨ ਦੇ ਲਾਗੇ ਪੈਂਦਾ ਅਤੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਉੱਥੇ ਵੀ ਬਹੁਤ ਵਧੀਆ ਚੀਜ਼ਾਂ ਤੁਹਾਨੂੰ ਮਤਲਬ ਖਾਣ ਵਾਸਤੇ ਮਿਲਣਗੀਆਂ ਪਿਓਰ ਵੈਜ ਹੈ ਅਤੇ ਜਿਹੜਾ ਸਵਾਦ ਹੈ ਉਹ ਵੀ ਉਹਨਾਂ ਦਾ ਬਿਲਕੁਲ ਪੇਂਡੂ ਸਟਾਈਲ ਦਾ ਮਤਲਬ ਤੁਹਾਨੂੰ ਜ਼ਿਲ੍ਹੇ ਦੇ ਬਾਰੇ ਪਤਾ ਲੱਗੇਗਾ ਕਿ ਹਾਂ ਬਈ ਆਪਾਂ ਕਿਤੇ ਜਾ ਕੇ ਜਿਹੜੀ ਰੋਟੀ ਖਾਧੀ ਹੈ